ਸਾਡੀ ਨਵਾਂ ਸ਼ਹਿਰ ਦੀ ਜੀ ਅਸੀਂ ਪੁਲਿਸ ਥਾਣੇ ਵਿੱਚ ਦੇਖੀ ਜਾਵੇ ਤਾਂ ਉੱਥੇ ਦਾ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਕਿ ਲੋਕਾਂ ਦੀਆਂ ਐਫ ਆਈ ਆਰ ਦਾ ਦਰਜ ਕਰਦਾ ਹੈ ਬਟ ਉਹ ਭਰਿਸ਼ਟਾਚਾਰ ਦੇ ਨਾਲ ਪ੍ਰਭਾਵਿਤ ਹੈ ਅਤੇ ਜਦ ਤੱਕ ਅਸੀਂ ਉਹਨੂੰ ਕੋਈ ਵੀ ਅਮਾਊਂਟ ਨਹੀਂ ਦੇ ਦਿੰਦੇ ਹੈਗੇ ਪੈਸੇ ਨਹੀਂ ਦੇ ਦਿੰਦੇ ਹੈਗੇ ਓਦੋਂ ਤੱਕ ਉਹ ਕਿਸੇ ਵੀ ਕਿਸੇ ਦਾ ਵੀ ਕੰਮ ਨਹੀਂ ਕਰਦਾ ਕੰਮ ਕਰਨ ਦਾ ਕਾਰਨ ਕੀ ਹੈ ਕਿ ਉਸਦੇ ਮੂੰਹ ਨੂੰ ਲੋਕਾਂ ਦਾ ਖੂਨ ਲੱਗਿਆ ਹੋਇਆ ਹੈ ਜਦੋਂ ਤੱਕ ਉਸ ਤੱਕ ਪੈਸੇ ਨਹੀਂ ਜਾਂਦੇ ਉਹ ਕੰਮ ਨਹੀਂ ਕਰਦਾ